ਪੈਟਰੋਲ ਨੇ ਗਰੀਬ ਲੋਕਾਂ ਦੀ ਬਹੁਤ ਢੂਹੀ ਤੋੜ ਰੱਖੀ ਹੈ ਇਹ ਬਹੁਤ ਮਹਿੰਗਾ ਹੋ ਗਿਆ ਪਰ ਇਹਦੇ ਬਿਨਾਂ ਗੁਜ਼ਾਰਾ ਵੀ ਨਹੀਂ ਹੁੰਦਾ ਹੁਣ ਜੇ ਕਿਤੇ ਜਾਣਾ ਪਹਿਲਾਂ ਤਾਂ ਲੋਕ ਪੈਦਲ ਚਲੇ ਜਾਇਆ ਕਰਦੇ ਤੇ ਪਰ ਹੁਣ ਅੱਜ ਕੱਲ੍ਹ ਟਾਇਮ ਇਹੋ ਜਿਹਾ ਆ ਗਿਆ ਵੀ ਹਰੇਕ ਬੱਚਾ ਚਾਹੇ ਬੁੱਢਾ ਬਾਇਕ ਦੀ ਵਰਤੋਂ ਕਰਦਾ ਪ ਚਾਹੇ ਮਹਿੰਗਾ ਹੋਵੇ ਸਸਤਾ ਹੋਵੇ ਪੈਟਰੋਲ ਤਾਂ ਉਹਨੂੰ ਪਵਾਉਣਾ ਹੀ ਪੈਣਾ ਨੰਬਰ ਦੋ 'ਤੇ ਤੁਸੀਂ ਗੱਲ ਬਾਲਣ ਦੀ ਕੀਤੀ ਹੈ ਜਿਹੜਾ ਬਾਲਣ ਦੀ ਵਰਤੋਂ ਆਪਾਂ ਕਰਦੇ ਹਾਂ ਇਹਦੇ ਨਾਲ਼ ਸਰੀਰ ਨੂੰ ਵੀ ਨੁਕਸਾਨ ਹੁੰਦਾ ਕੱਪੜੇ ਵੀ ਕਾਲੇ ਹੁੰਦੇ ਹੈ ਅਤੇ ਜਿਹੜਾ ਹੈ ਸਾਡੀਆਂ ਅੱਖਾਂ ਨੂੰ ਵੀ ਨੁਕਸਾਨ ਦਿੰਦਾ ਹੈ ਅਤੇ ਨੰਬਰ ਦੋ 'ਤੇ ਜਿਹੜਾ ਹੈਗਾ ਇਹ ਸਾਹ ਨੂੰ ਵੀ ਪ੍ਰੋਬਲਮ ਆਉਂਦੀ ਹੈ ਇਹ ਬਾਲਣ ਦੀ ਪ੍ਰੋਲਮ ਨੰਬਰ ਤਿੰਨ 'ਤੇ ਅੱਜ ਕੱਲ੍ਹ ਗੈਸ ਆ ਗਈ ਗੈਸ ਆ ਗਈ ਇਹਦੇ ਨਾਲ਼ ਵੀ ਹੁਣ ਲੋਕਾਂ ਦੇ ਜਿਹੜੇ ਗੋਡੇ ਗਿੱਟੇ ਖੜ੍ਹਦੇ ਆ ਉਹ ਗੈਸ ਨ ਮਿਹਨਤ ਨਹੀਂ ਕਰਦੇ ਜੇ ਸਿਲੰਡਰ ਵੀ ਚੱਕਣਾ ਉਹ ਵੀ ਖ ਕਿਸੇ ਦੂਜੇ ਨੂੰ ਹੀ ਕਹਿੰਦੇ ਵੀ ਲਿਆ ਕੇ ਇੱਧਰ ਲਾ ਦੇ ਪਹਿਲਾਂ ਲੋਕ ਬੈਠ ਕੇ ਹੁੰ ਖੜ੍ਹੇ ਕਰਦੇ ਲੱਕੜੀਆਂ ਲਿਆਉਣ ਤੇ ਸਾਡੇ ਵੀ ਟਾਈਮ ਦੀ ਗੱਲ ਆਈ ਆਪਣੇ ਖੇਤਾਂ 'ਚੋਂ ਵੀ ਜੋ ਵੀ ਟਾਹਲੀ ਟੁਹਲੀ ਆ ਵੱਢ ਵੁੱਢ ਕੇ ਲਿਆਉਂਦੇ ਹੁੰਦੇ ਤੇ ਅਤੇ ਅੱਜ ਕੱਲ੍ਹ ਇਹ ਟਾਈਮ ਬਿਲਕੁਲ ਹੈ ਨਹੀਂ ਅਤੇ ਲੋਕਾਂ ਦੇ ਜਿਹੜੇ ਗੋਡੇ ਗਿੱਟੇ ਹੈ ਖੜ੍ਹ ਗਏ ਗੈਸ ਖੜ੍ਹ ਕੇ ਰੋਟੀ ਬਣਾ ਲੈਂਦੇ ਹਾਂ ਉਹ ਤੋਂ ਬਾਅਦ ਬਹਿ ਕੇ ਰੋਟੀ ਖਾ ਲੈਂਦੇ ਹਾਂ ਕੋਈ ਉਹ ਜੀ ਵਜ਼ਨ ਨਹੀਂ ਆਪਣੇ ਸਰੀਰ ਦੇ ਵਿੱਚ ਦਿੰਦੇ ਅਤੇ ਨਾ ਸਰੀਰ ਨੂੰ ਗਰਮੀ ਆਉਣ ਦਿੰਦੇ ਕਈ ਲੋਕਾਂ ਦਾ ਰਸੋਈਆਂ ਦੇ ਵਿੱਚ ਵੀ ਪੱਖੇ ਲਗਵਾਏ ਹੋਏ ਹੈ ਇਹਦੇ ਕਰਕੇ ਇਹ ਬਹੁਤ ਜਿਹੜੀ ਲੋਕਾਂ ਪਰ ਅਸਰ ਪੈਂਦਾ ਇਹ ਬਹੁਤ ਜਿਹੜਾ ਬਹੁਤ ਸਰੀਰ ਨੂੰ ਬਹੁਤ ਨੁਕਸਾਨਦੇਹ ਹੈ